ਹੈਲੋ ਨਮਸਤੇ ਮੈਡਮ ਜੀ ਕੀ ਹਾਲ ਚਾਲ ਹੈ ਸਾਡਾ ਵੀ ਠੀਕ ਹੈ ਹੋਰ ਦੱਸੋ ਫੇਰ ਮੇਰੇ ਬੱਚੇ ਦਾ ਰਿਜ਼ਲਟ ਕਿੱਦਾਂ ਦਾ ਆਇਆ ਹੈ ਹਮ ਮੈਡਮ ਜੀ ਪੜ੍ਹਦਾ ਵੀ ਨਹੀਂ ਹੈ ਤੁਸੀਂ ਥੋੜ੍ਹਾ ਡਾਂਟ ਕੇ ਰੱਖਿਆ ਕਰੋ ਨਾ ਇਹਨੂੰ ਬੜੀ ਮੁਸ਼ਕਲ ਗੁੱਸਾ ਗਾਸਾ ਕਰ ਕੇ ਕਿਤੇ ਮਾਰ ਮੂਰ ਖਾ ਕੇ ਬਹਿੰਦਾ ਜੀ ਅੱਧਾ ਪੌਣਾ ਘੰਟਾ ਉਸ ਤੋਂ ਜ਼ਿਆਦਾ ਤਾਂ ਬਹਿੰਦਾ ਹੀ ਨਹੀਂ ਹੈ ਬੜਾ ਖਪਾਉਂਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਹੋਰ ਨੰਬਰ ਕਿਸ ਤਰ੍ਹਾਂ ਦੇ ਆਏ ਵੇ ਬਾਕੀ ਸਬਜੈਕਟਾਂ 'ਚੋਂ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਹੋਰ ਕਲਾਸ 'ਚ ਸ਼ਰਾਰਤਾਂ ਸ਼ਰੁਰਤਾਂ ਕਿਸ ਤਰ੍ਹਾਂ ਦੀਆਂ ਐਂ ਅਤੇ ਇਹਨੂੰ ਇਹਨੂੰ ਕਿਹੇ ਉਹ ਇਹਨੂੰ ਕਿਸੇ ਨਿਆਣੇ ਲਾਗੇ ਪੜ੍ਹ ਬਿਠਾਓ ਨਾ ਜਿਹੜਾ ਬੱਚਾ ਪੜ੍ਹਨ ਵਾਲਾ ਹੁਸ਼ਿਆਰ ਹੋਵੇ ਸ਼ਰਾਰਤੀ ਬੱਚਿਆਂ ਲਾਗਿਓਂ ਇਹਦੀ ਸੀਟ ਚੇਂਜ ਕਰ ਦਿਓ ਜਿੱਦਾਂ ਆਪਣੇ ਕੋਲ ਆਪਣੇ ਕੋਲ ਬਿਠਾ ਲਿਆ ਕਰੋ ਨਾ ਥੋੜ੍ਹਾ ਕੀ ਇਹਨੂੰ ਇਹਦੇ ਵੱਲ ਧਿਆਨ ਦੇ ਗੱਲਾਂ ਵੀ ਬੜੀਆਂ ਕਰਦਾ ਸ਼ਰਾਰਤੀ ਤਾਂ ਹੈ ਹੀ ਹੈ ਤਾਂ ਆਪਣੇ ਕੋਲ ਬਿਠਾ ਲਿਆ ਕਰੋ ਨਾ ਕਿ ਥੋੜਾ ਜਿਹਾ ਇਹਦੇ ਵੱਲ ਧਿਆਨ ਰਹੇਗਾ ਬਾਕੀ ਕੋਈ ਨਹੀਂ ਜੇ ਤੁਸੀਂ ਕਹਿੰਦੇ ਤਾਂ ਅਸੀਂ ਟਿਊਸ਼ਨ ਠੀਕ ਹੈ ਜੀ ਨਹੀਂ ਤਾ ਇਹਦੀ ਟਿਊਸ਼ਨ ਰਖਵਾ ਦੇਈਏ ਇਹਦੀ ਹਾਂਜੀ ਘਰ ਫੇਰ ਘੱਟ ਹੀ ਪੜ੍ਹੇ ਲਿਖੇ ਦੇ ਨਾ ਸਾਰੇ ਤੇ ਕੋਈ ਪੜ੍ਹਾ ਵੀ ਨਹੀਂ ਸਕਦਾ ਇਹਨੂੰ ਦੋ ਘੰਟੇ ਟਿਊਸ਼ਨ ਪੜ੍ਹ ਆਵੇਗਾ ਬਾਕੀ ਤੁਸੀਂ ਆਪਣੀ ਮਿਹਨਤ ਕਰਾ ਹੀ ਲੈਣੀ ਹੈ ਇਹਨੂੰ

ਠੀਕ ਹੈ ਠੀਕ ਓਕੇ ਜੀ ਓਕੇ ਮੈਮ